ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਓ ਜੀ ਹਾਂਜੀ ਅੱਛਾ ਜੀ ਤੇ ਕਿੰਨਾ ਨੰਬਰ ਚਾਹੀਦਾ ਹੈ ਅੱਛਾ ਕਿਹੜੀ ਜੁੱਤੀ ਲੈਣੀ ਤੁਸੀਂ ਪੰਜਾਬੀ ਲੈਣੀ ਅੱਛਾ ਪੰਜਾਬੀ ਦੇਖ ਲਓ ਹਾਂਜੀ ਹਾਂਜੀ ਆਹ ਨਾ ਆਪਣੇ ਸਾਮਣੇ ਲੱਗੀਆਂ ਇੱਧਰ ਆਹ ਉੱਪਰ ਪੰਜਾਬੀ ਲੱਗੀਆਂ ਹੋਈਆਂ ਆਹ ਨੀਚੇ ਆਹ ਵਾਲੀ ਲਾਈਨ ਜਿਹੜੀ ਇਹਦੇ ਵਿਚ ਹੀਲ ਵਾਲੀ ਲੱਗੀ ਹੋਈ ਤੁਸੀਂ ਦੱਸੋ ਕਿਹੜੀ ਲਾਈਏ ਅੱਛਾ ਜੀ ਹਾਂਜੀ ਅੱਛਾ ਅੱਛਾ ਜੀ ਠੀਕ ਹੈ ਚੱਲ ਇਹ ਲਾਹ ਦਿੰਦੇ ਹਾਂ ਹਾਂਜੀ ਆ ਲਓ ਜੀ ਹਾਂਜੀ ਦੇਖੋ ਜੀ ਉਹ ਰੰਗ ਇਹ ਆਹ ਰੰਗ ਤਿੰਨ ਚਾਰ ਹੈਗੇ ਨੇ ਤਿੰਨ ਚਾਰ ਹੀ ਲਾ ਉਤਾਰ ਲਾਹ ਦਿੰਨਦੇ ਹਾਂ ਤੁਸੀਂ ਪਸੰਦ ਕਰ ਲਓ ਕਿਹੜਾ ਕਰਨਾ ਹਾਂਜੀ ਇਹ ਆ ਲਾਹ ਦਿੱਤੀ ਜੀ ਆ ਆਹ ਲਓ ਜੀ ਹਾਂਜੀ ਅੱਛਾ ਇਹ ਨਹੀਂ ਪਸੰਦ ਉਹ ਜਿਹੜੀ ਤੁਸੀਂ ਜੇ ਤੁਸੀਂ ਪੰਜਾਬੀ ਅਤੇ ਹਾਂਜੀ ਉਹ ਫਿਰ ਇਵੇਂ ਨਾ ਉਹ ਹੀ ਉਹ ਹੀ ਡੱਬੇ ਲਾਹਵਾਂਗੇ ਨਾ ਜੇ ਤੁਸੀਂ ਪੰਜਾਬੀ ਪਸੰਦ ਕਰ ਲਓ ਉਹ ਆਪਾਂ ਸਾਈਡ 'ਤੇ ਕਰ ਦਿੰਦੇ ਹਾਂ ਫਿਰ ਮੈਂ ਤੁਹਾਨੂੰ ਹੀਲ ਵਾਲੀ ਦਿਖਾ ਦਿੰਦੀ ਹਾਂ ਅੱਛਾ ਕਿਹੜਾ ਫਿਰ ਰੰਗ ਪਸੰਦ ਕੀਤਾ ਤੁਸੀਂ ਅੱਛਾ ਅੱਛਾ ਆਹ ਲਓ ਇੱਕ ਇੱਕ ਸਾਈਡ 'ਤੇ ਕਰਤੀਆਂ ਹਾਂਜੀ ਹੁਣ ਇਹ ਇਹ ਵੀ ਛੇ ਨੰਬਰ ਹੀ ਚਾਹੀਦਾ ਅੱਛਾ ਹਾਂਜੀ ਆ ਪੰਜਾਬੀ ਹੈ ਜੀ ਆਹ ਹੀਲ ਵਾਲੀ ਹੈ ਦੇਖ ਲਓ

ਫਿਰ ਇਸ 'ਤੇ ਇਹ ਤਾਂ ਇੰਨੇ 'ਚ ਹੀ ਆਉਂਦੀਆਂ ਹੀਲ ਵਾਲੀਆਂ ਅਤੇ ਅੰਗੂਠੇ ਵਾਲੀ ਚੱਪਲ ਵਧੀਆ ਫੈਂਸੀ ਵਾਲੀ ਉਹ ਵੇਖ ਲਓ

ਇਸ ਤੋਂ ਘੱਟ ਇਹਦੇ 'ਚ ਤਾਂ ਇੰਨੀ ਆਉਂਦੀ ਪਈ ਆ ਹੀਲ ਅਤੇ ਆਹ ਵਾਲੀ ਜਿਹੜੀ ਹੈ ਨਾ ਆਹ ਦੇਖ ਲਓ ਇਹ ਉਹਦੇ ਤੋਂ ਐਵੇਂ ਬੇ ਮਲੂਮੀ ਅੱਡੀ ਹੈ ਬਸ ਜ਼ਿਆਦਾ ਨਹੀਂ ਹੀਲ ਹੈਗੀ ਉਹ ਉਹ ਇਸ ਤੋਂ ਵਧੀਆ 'ਚ ਫਿਰ ਇਹ ਹੀ ਹੈਗੀ ਹੋਰ ਤਾਂ ਨਹੀਂ ਹੈਗੀ ਆਂ ਬੱਚਿਆਂ ਲਈ ਵੇਖਣੀ ਹੈ ਇਹਨਾਂ ਵਿੱਚੋਂ ਹੁਣ ਤੁਹਾਨੂੰ ਕਿਹੜੀ ਪਸੰਦ ਸੀ ਉਹ ਸਾਈਡ 'ਤੇ ਕਰ ਦਿੰਦੇ ਹਾਂ ਅਤੇ ਫਿਰ ਬੱਚਿਆਂ ਲਈ ਬਾਅਦ 'ਚ ਕੱਢਦੇ ਅੱਛਾ ਠੀਕ ਆ ਅਤੇ ਬੱਚੇ ਦਾ ਕਿੰਨਾ ਨੰਬਰ ਹੋਣਾ ਚਾਹੀਦਾ ਤੇਰ੍ਹਾਂ ਨੰਬਰ ਇਹ ਉਹ ਬੱਚੇ ਦੇ ਤੁਸੀਂ ਕਾਹਦੇ 'ਚ ਲੈਣੇ ਆ ਬੂਟ ਲੈਣੇ ਕਿ ਕਿਵੇਂ ਇਹ ਕਾਕੇ ਦੀ ਹੈ ਕਿ ਗੁਡੀਆ ਦੀ ਹੈ ਗੁਡੀਆ ਦੀ ਕਾ ਕਿਹੜੇ ਬੂਟ ਦੇਖਣੇ ਆ ਇੱਕ ਤਾਂ ਵੀ ਜਿਵੇਂ ਆਮ ਸਕੂਲਾਂ 'ਚ ਲੱਗਦੇ ਨੇ ਇੱਕ ਕੱਪੜੇ 'ਚ ਆ

ਸਿੰਪਲ ਅੱਛਾ ਜੀ ਠੀਕ ਹੈ ਜੀ ਆਹ ਪਈਆਂ ਹੋਈਆਂ ਜੀ ਆਹ ਆਹ ਵਾਲੀ ਲਾਈਨ ਵਾਲੀਆਂ ਹਾਂਜੀ ਆਹ ਦੇਖ ਲਓ ਇਹ ਹੀ ਆ ਵ ਹਾਂਜੀ ਇਹਨਾਂ ਚੋਂ ਤਾਂ ਪਸੰਦ ਵੇਖ ਲਵੋ ਮਾਲ ਫਿਰ ਆਉਣ ਵਾਲਾ ਜੀ ਇਹ ਹੀ ਆਪਣੇ ਕੋਲ ਮਾਲ ਹੈ ਬਸ ਤੁਸੀਂ ਦੇਖ ਲਵੋ ਜੇ ਕਹੋ ਤਾਂ ਕੱਲ੍ਹ ਆ ਜਾਏਗਾ ਹਾਂਜੀ ਕੱਲ੍ਹ ਆ ਜਾਏਗਾ ਫਿਰ ਤੁਸੀਂ ਦੇਖ ਲਓ ਜੇ ਕਹੋ ਤਾਂ ਮੰਗਵਾ ਦਿੰਦੇ ਹਾਂ ਅੱਛਾ ਇਹ ਨਹੀਂ ਪਸੰਦ ਲੱਗੀ ਰੇਟ ਜਿਹੜੀ ਪੰਜਾਬੀ ਜੁੱਤੀ ਆ ਉਹ ਤਾਂ ਹਜ਼ਾਰ ਕੁ ਦੀ ਹੈ ਜੀ ਹਾਂਜੀ ਉਹ ਤੁਸੀਂ ਜੇ ਵੇਖ ਲਓ ਸਾਢੇ ਪੰਜ ਸੌ ਪੰਜ ਸੌ ਲਾ ਲਾਂਗੇ ਜੀ ਕੋਈ ਗੱਲ ਨਹੀਂ ਹਾਂਜੀ ਤੁਸੀਂ ਅੱਗੇ ਵੀ ਆਪਣੇ ਅੱਗੇ ਵੀ ਆਪਣੀਆਂ ਦੁਕਾਨ ਤੋਂ ਹੀ ਜਾਂਦਾ ਮਾਲ ਇਸ ਕਰਕੇ ਤੁਹਾਨੂੰ ਕੋਈ ਨਹੀਂ ਹਾਂਜੀ ਹਾਂਜੀ ਚਲੋ ਠੀਕ ਹੈ ਜੀ ਹਾਂਜੀ ਆ ਲੈ ਲਓ ਹਾਂਜੀ ਆਹ ਲਿਫਾਫੇ 'ਚ ਪਾ ਦਿੰਦੀ ਹਾਂ ਆਹ ਲਓ ਠੀਕ ਹੈ ਜੀ ਆਹ ਲਓ ਜੀ ਧੰਨਵਾਦ ਜੀ ਓਕੇ